ਸਤਿ ਸ਼੍ਰੀ ਅਕਾਲ ਸਰ ਮੈਂ ਗਗਨਪ੍ਰੀਤ ਕੌਰ ਪਠਾਨਕੋਟ ਦੀ ਰਹਿਣ ਵਾਲੀ ਹਾਂ ਅਤੇ ਮੈਂ ਇੱਕ ਵਾਰੀ ਇੱਕ ਇਹੋ ਜਿਹੀ ਚੀਜ਼ ਬਣਾਈ ਸੀ ਜਿਹਦੇ ਨਾਲ ਮੇਰੇ ਮਨ ਉੱਤੇ ਬਹੁਤ ਡੂੰਘਾ ਪ੍ਰਭਾਵ ਪਿਆ ਅਤੇ ਮੈਂ ਇੱਕ ਵਾਰੀ ਨਾ ਪੈਨਸਲ ਸਟੈਂਡ ਬਣਾਇਆ ਸੀ ਅਤੇ ਵੇਸਟ ਪੈਂਸਿਲ ਮਤਲਬ ਕਿ ਆਈਸਕ੍ਰੀਮ ਦੀ ਵੇਸਟ ਸ ਡੰਡਿਆਂ ਦਾ ਕ ਕਲੈਕਸ਼ਨ ਕਰਕੇ ਅਤੇ ਉਹਦਾ ਮੈਂ ਪੈਨਸਲ ਸਟੈਂਡ ਬਣਾਇਆ ਅਤੇ ਉਹ ਪੈਨਸਲ ਸਟੈਂਡ ਮੈਂ ਨਾ ਉਹ ਜਿਹੜੇ ਆਈਸਕ੍ਰੀਮ ਸਟਿਕ ਸੀ ਉਹ ਮੈਂ ਪਹਿਲਾਂ ਫੈਂਕਣ ਲੱਗੀ ਸੀ ਡਸਟਬਿਨ ਵਿੱਚ ਅਤੇ ਮੈਂ ਉਹਨੂੰ ਇਕੱਠਾ ਕੀਤਾ ਅਤੇ ਮੈਂ ਉਹਨੂੰ ਜੋੜ ਜੋੜ ਕੇ ਜੋੜ ਜੋੜ ਕੇ ਪੈਨਸਲ ਸਟੈਂਡ ਬਣਾ ਲਿਆ ਅਤੇ ਇੱਕ ਦਿਨ ਮੈਂ ਬਾਹਰ ਗਈ ਅਤੇ ਫਿਰ ਮੈਂ ਘਰ ਆਈ ਫਿਰ ਉਸ ਪੈਨਸਲ ਸਟੈਂਡ ਨੂੰ ਦੇਖਿਆ ਅਤੇ ਮੇਰੇ ਮਨ 'ਚ ਬੜਾ ਡੂੰਘਾ ਪ੍ਰਭਾਵ ਪਿਆ ਕਿ ਅਸੀਂ ਵੇਸਟ ਚੀਜ਼ਾਂ ਸੁੱਟ ਦਿੰਦੇ ਹਾਂ ਅਤੇ ਉਹਦਾ ਯੂਜ ਬਹੁਤ ਤਰੀਕਿਆਂ ਵਿੱਚ ਹੁੰਦਾ ਹੈ ਅਤੇ ਮੈਂ ਉਸ ਤੋਂ ਬਾਅਦ ਆਪਣੇ ਘਰ ਵਿੱਚ ਕੋਈ ਵੀ ਵੇਸਟ ਚੀਜ਼ ਸੁੱਟਣਾ ਬੰਦ ਕਰਤਾ ਮੈਂ ਉਸ ਵੇਸਟ ਚੀਜ਼ ਨੂੰ ਇਕੱਠਾ ਕਰ ਕਰ ਕੇ ਕਦੇ ਕੁਝ ਬਣਾਇਆ ਕਦੇ ਕੁਝ ਬਣਾਇਆ ਕਦੇ ਕਦੇ ਮੈਂ ਫਲਾਵਰ ਮਤਲਬ ਕਿ ਫਲਾਵਰ ਪੋਟ ਮਤਲਬ ਬਣਾਏ ਵੇਸਟ ਚੀਜ਼ਾਂ ਨਾਲ ਕਦੇ ਕਦੇ ਮੈਂ ਗੁਲਦਸਤੇ ਬਣਾਏ ਅਤੇ ਪੇਪਰ ਦੇ ਵੀ ਮੈਂ ਗੁਲਦਸਤੇ ਫਲਾਵਰ ਵਗੈਰਾ ਬਣਾਏ ਅਤੇ ਉਹਨੂੰ ਇਕੱਠੇ ਕਰ ਕਰਕੇ ਘਰ ਵਿਚ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਅਤੇ ਮੇਰੇ ਫਰੈਂਡਸ ਵੀ ਘਰ ਆਏ ਉਹਨਾਂ ਨੇ ਵੀ ਦੇਖਿਆ ਕਿ ਘਰ ਵਿੱਚ ਕਿੰਨੀ ਸੋਹਣੀ ਡੈਕੋਰੇਸ਼ਨ ਹੋਈ ਹੈ ਉਹਨਾਂ ਨੇ ਮੈਨੂੰ ਪੁੱਛਿਆ ਕਿ ਕਿੰਨੇ ਬਣਾਏ ਆ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਬਣਾਏ ਆ ਅਤੇ ਫਿਰ ਮੈਂ ਕਾਲਜ ਵਿੱਚ ਵੀ ਮੇਰਾ ਐਗਜੀਵੇਸ਼ਨ ਸੀ ਅਤੇ ਮੈਂ ਕੋਲਜ ਵਿੱਚ ਗਈ ਉੱਥੇ ਹੀ ਮੈਂ ਇਹੀ ਵੇਸਟ ਚੀਜ਼ਾਂ ਦਾ ਸ ਬਣਾਇਆ ਅਤੇ ਉਹਨਾਂ ਨੇ ਮੈਨੂੰ ਫਸਟ ਪ੍ਰਾਈਜ਼ ਦਿੱਤਾ ਕਿਉਂਕਿ ਵੇਸਟ ਮਟੀਰੀਅਲ ਯੂਜ ਕਰਕੇ ਮੈਂ ਬਣਾਇਆ ਸੀ ਅਤੇ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਅਤੇ ਮੈਂ ਫਸਟ ਪ੍ਰਾਈਜ਼ ਲਿਆ ਅਤੇ ਇਸ ਕਰਕੇ ਮੈਂ ਉਸ ਤੋਂ ਬਾਅਦ ਕਦੇ ਵੀ ਵੇਸਟ ਮਟੀਰੀਅਲ ਸੁੱਟਣਾ ਬੰਦ ਕਰਤਾ ਅਤੇ ਮੈਂ ਪਲਾਸਟਿਕ ਦੇ ਜਿੱਦਾਂ ਡੱਬੇ ਹੁੰਦੇ ਸੀ ਉਹ ਥੋੜ੍ਹੇ ਬਹੁਤ ਟੁੱਟ ਜਾਂਦੇ ਉਹਨਾਂ ਨੂੰ ਮੈਂ ਥੋੜ੍ਹਾ ਬਹੁਤਾ ਰਿਪੀਅਰ ਕਰਕੇ ਉਹਨਾਂ 'ਤੇ ਪੇਂਟ ਕਰਕੇ ਅਤੇ ਉਹਨਾਂ ਵਿੱਚ ਮ ਮਿੱਟੀ ਪਾ ਕੇ ਅਤੇ ਉਹਨਾਂ ਵਿੱਚ ਫਲਾਵਰ ਵਗੈਰਾ ਪੋ ਲਗਾ ਲੈਂਦੀ ਸੀ ਅਤੇ ਉਹਦਾ ਮੈਨੂੰ ਵੇਸਟ ਚੀਜ਼ਾਂ ਦਾ ਵੀ ਬਹੁਤ ਸੋਹਣਾ ਮੇਰਾ ਬਹੁਤ ਸੋਹਣਾ ਗਾਰਡਨ ਵੇਸਟ ਮਟੀਰੀਅਲ ਨਾਲ ਬਣ ਗਿਆ ਸੀ ਸਾਰਿਆਂ ਨੂੰ ਪਸੰਦ ਆਉਂਦਾ ਸੀ ਅਤੇ ਮੈਂ ਉਹੀ ਵੇਸਟ ਚੀਜ਼ਾਂ ਨੂੰ ਇਕੱਠਾ ਕਰਕੇ ਬਹੁਤ ਸੋਹਣਾ ਨਾ ਉਹਨਾਂ ਦਾ ਯੂਜ ਕੀਤਾ ਧੰਨਵਾਦ